ਹਾਂਜੀ ਮੈਂ ਤੁਹਾਡੇ ਨਾਲ ਇੱਕ ਵਾਕਿਆ ਸਾਂਝਾ ਕਰਨਾ ਚਾਹੁੰਦਾ ਹਾਂ ਜਿਹਦੇ ਵਿੱਚ ਅਸੀਂ ਅਤੇ ਮੇਰਾ ਪਰਿਵਾਰ ਨਾਲ ਇੱਕ ਛੋ ਛੋਟੇ ਬੱਚੇ ਸੀ ਮੇਰੀ ਵਾਈਫ ਸੀ ਅਤੇ ਇੱਕ ਮੇਰਾ ਬੇਟਾ ਸੀ ਇੱਕ ਬੇਟੀ ਸੀ ਅਸੀਂ ਚੰਡੀਗੜ੍ਹ ਤੋਂ ਰਾਤ ਨੂੰ ਟ੍ਰੇਨ ਰਾਹੀਂ ਹਜ਼ੂਰ ਸਾਹਿਬ ਤੋਂ ਉੱਥੇ ਪਰਤੇ ਟ੍ਰੇਨ ਤਕਰੀਬਨ ਰਾਤ ਨੂੰ ਦੋ ਦਿਨ ਵਿ ਦੇ ਰਾਤ ਦੇ ਦੋ ਵੱਜ ਚੁੱਕੇ ਸੀ ਜਿਹੜੇ ਕੀ ਸਵੇਰ ਦੀ ਵੀ ਆਪਾਂ ਗਿਣ ਸਕਦੀ ਆ ਦੋ ਵਜੇ ਸਵੇਰੇ ਪਹੁੰਚੀ ਸੀ ਟ੍ਰੇਨ ਅਤੇ ਟ੍ਰੇਨ ਤੋਂ ਨਿਕਲਦੇ ਸਾਰ ਸਾਨੂੰ ਕੁਛ ਪਤਾ ਨਹੀਂ ਲੱਗਿਆ ਵੀ ਅਸੀਂ ਕਿੱਦਾਂ ਪਹੁੰਚੀਏ ਆਪਣੇ ਘਰ ਜਦੋਂ ਟ੍ਰੇਨ ਤੋਂ ਬਾਅਦ ਸਾਨੂੰ ਇੱਕ ਕੈਬ ਡਰਾਈਵਰ ਮਿਲਿਆ ਉੱਥੇ ਅਤੇ ਪਹਿਲਾਂ ਤਾਂ ਸਾਨੂੰ ਬਹੁਤ ਡਰ ਲੱਗਿਆ ਵੀ ਕੈਬ ਡਰਾਈਵਰ ਪਤਾ ਨਹੀਂ ਅੱਜ ਕੱਲ੍ਹ ਹਾਲਾਤ ਇੱਦਾਂ ਦੇ ਨੇ ਵੀ ਸਾਨੂੰ ਵੀ ਕਿਸ ਤਰ੍ਹਾਂ ਦਾ ਡਰਾਈ ਉਹ ਦਾ ਰਵੱਈਆ ਕਿੱਦਾਂ ਦਾ ਹੋਏਗਾ ਕਿ ਲੁੱਟਣ ਖੋਹਣ ਵਾਲਾ ਅੱਜ ਕੱਲ੍ਹ ਬਹੁਤ ਕੁਛ ਐਕਟਿਵ ਹੋਏ ਪਏ ਨੇ ਅਤੇ ਫਿਰ ਵੀ ਚੱਲੋ ਅਸੀਂ ਹਿੰਮਤ ਕਰੀ ਅਤੇ ਕੈਬ ਡਰਾਈਵਰ ਨੂੰ ਅਸੀਂ ਪੁੱਛਿਆ ਪੁੱਛਗਿਛ ਕਰਨ ਤੋਂ ਬਾਅਦ ਸਾਨੂੰ ਉਹ ਠੀਕ ਲੱਗਿਆ ਅਤੇ ਉਹਦੀ ਆਈ ਡੀ ਵਗੈਰਾ ਦੇਖੀ ਅਤੇ ਉਹਦਾ ਨੰਬਰ ਪਲੇਟ ਵਗੈਰਾ ਸਾਰਾ ਅਸੀਂ ਚੈੱਕ ਕਰਕੇ ਉਹਦਾ ਔਨਲਾਈਨ ਅਸੀਂ ਦੇਖਿਆ ਵੀ ਰਿਕੋਡ ਚੜ੍ਹਿਆ ਹੈ ਜੀ ਫਿਰ ਸਾਨੂੰ ਥੋੜ੍ਹਾ ਯਕੀਨ ਹੋ ਗਿਆ ਵੀ ਅਸੀਂ ਇਸ ਨੂੰ ਬੁੱਕ ਕਰਕੇ ਅਸੀਂ ਆਪਣੇ ਘਰ ਵਾਪਸ ਆ ਸਕਦੇ ਅਤੇ ਰਸਤੇ ਵਿੱਚ ਵੀ ਇੱਦਾਂ ਹੀ ਹੋਇਆ ਕੈਬ ਡਰਾਈਵਰ ਬੜਾ ਅੱਛਾ ਨਿਕਲਿਆ ਨੇਕ ਦਿਲ ਦਾ ਸੀ ਅਤੇ ਉਸਨੇ ਸਾਨ ਨਾਲ ਗੱਲਾਂ ਬਾਤਾਂ ਵੀ ਕਰੀਆਂ ਅਤੇ ਗੱਲਾਂ ਬਾਤਾਂ ਕਰਨ ਦੇ ਦੌਰਾਨ ਅਤੇ ਕੁਛ ਅਸੀਂ ਸ਼ੇਅਰ ਵੀ ਕੀਤਾ ਆਪਸ ਵਿੱਚ ਅਤੇ ਉਹਦੇ ਪਰਿਵਾਰ ਬਾਰੇ ਵੀ ਅਸੀਂ ਪੁੱਛਿਆ ਅਤੇ ਆਪਣੇ ਪਰਿਵਾਰ ਬਾਰੇ ਵੀ ਦੱਸਿਆ ਇਸ ਪਰ ਇਸ ਗੱਲਬਾਤ ਤੋਂ ਸਾਨੂੰ ਇੱਦਾਂ ਲੱਗ ਰਿਹਾ ਸੀ ਜਿਵੇਂ ਉਹ ਸਾਡਾ ਘਰ ਦਾ ਹੀ ਮੈਂਬਰ ਹੋਵੇ ਅਤੇ ਬਾਹਲਾ ਸਾਨੂੰ ਮਿਲ ਕੇ ਉਹਨੂੰ ਅੱਛਾ ਲੱਗਿਆ ਅਤੇ ਦੇਰ ਰਾਤ ਨੂੰ ਅਸੀਂ ਫਿਰ ਆਪਣੇ ਇੱਕ ਘੰਟੇ ਦੇ ਸਫਰ ਤੋਂ ਬਾਅਦ ਅਸੀਂ ਆਪਣੇ ਘਰ ਪਹੁੰਚ ਗਏ ਘਰ ਪਹੁੰਚਣ ਤੋਂ ਬਾਅਦ ਅਸੀਂ ਉਸਨੂੰ ਚਾਹ ਪਾਣੀ ਪੁੱਛਿਆ ਚਾਹ ਪਾਣੀ ਪੁੱਛਣ ਤੋਂ ਬਾਅਦ ਫਿਰ ਉਸਦੀ ਬਣਦਾ ਮਿਹਨਤ ਦਾ ਹੱਕ ਉਸਨੂੰ ਪ੍ਰਦਾਨ ਕੀਤਾ ਅਤੇ ਉਸ ਤੋਂ ਬਾਅਦ ਫਿਰ ਅਸੀਂ ਉਸ ਨੂੰ ਅਲਵਿਦਾ ਕਿਹਾ